ਅੱਜ ਕੱਲ੍ਹ ਦੇ ਦੌਰ ਵਿੱਚ ਵਿਗਿਆਪਨ ਕਾਰਨ ਬਹੁਤ ਸਾਰੇ ਤਰੀਕੇ ਹਨ ਜਿਸਦੇ ਨਾਲ ਸਾਰੇ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਜਿਵੇਂ ਕਿ ਅੱਜ ਕੱਲ੍ਹ ਬ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਔਨਲਾਈਨ ਹੋ ਗਈਆਂ ਹਨ ਅਤੇ ਵਿਗਿਆਪਨ ਵੀ ਔਨਲਾਈਨ ਹੋ ਗਿਆ ਹੈ ਜਿਵੇਂ ਕਿ ਸ਼ੋਸ਼ਲ ਮੀਡੀਆ ਐਪ ਵਟਸਐਪ ਫੇਸਬੁੱਕ ਸਭ ਤੋਂ ਵਧੇਰੇ ਇਸ਼ਤਿਹਾਰ ਕਰਨ ਵਾਲੀ ਵੈੱਬਸਾਈਟ ਯੂਟਿਊਬ ਅਤੇ ਅਖ਼ਬਾਰਾਂ ਵੀ ਬਹੁਤ ਇਸ਼ਤਿਹਾਰ ਦਿੰਦੇ ਹਨ ਜਿਵੇਂ ਟੈਲੀਵਿਜ਼ਨ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਅਸੀਂ ਹਰ ਰੋਜ਼ ਅਖ਼ਬਾਰਾਂ ਵਿੱਚ ਆਈਲੈਟਸ ਦੇ ਇਸ਼ਤਿਆਰ ਵੀ ਦੇਖਦੇ ਹਾਂ ਅਤੇ ਬਹੁਤ ਸਾਰੀਆਂ ਸਾਈਟਾਂ ਜਿਵੇਂ ਕਿ ਫੇਸਬੁੱਕ 'ਤੇ ਇਸ਼ਤਿਹਾਰ ਮਿਲਦੇ ਨੇ ਹੋਰ ਬਹੁਤ ਸਾਰੀਆਂ ਸਾਈਟਾਂ ਨੇ ਜਿਵੇਂ ਯੂਟਿਊਬ 'ਤੇ ਵੀ ਇਸ਼ਤਿਹਾਰ ਮਿਲਦੇ ਨੇ ਬਹੁਤ ਸਾਰਾ ਕੁਛ ਵਿਆਪਨ ਦੇ ਨਾਲ ਹੀ ਸੰਬ ਸੰਬੰਧਿਤ ਹੈ